ਚਾਰ ਦਸੰਬਰ ਉੱਨੀ ਸੌ ਚੁਰਾਨਵੇਂ ਇੱਕੀ ਸਤੰਬਰ ਅਠਾਰਾਂ ਸੌ ਨੜਿਨਵੇਂ ਪੰਜ ਮਾਰਚ ਉੱਨੀ ਸੌ ਚੁਰਾਸੀ ਦੋ ਅਕਤੂਬਰ ਪੰਦਰਾਂ ਸੌ ਸੱਠ ਬਾਰ੍ਹਾਂ ਜਨਵਰੀ ਦੋ ਹਜ਼ਾਰ ਛੇ